ਹੈਲੋ ਹਾਂਜੀ ਕਿਵੇਂ ਹੋ ਹਾਂਜੀ ਵਧੀਆ ਆਪਣਾ ਪਰਿਵਾਰ ਵਧੀਆ ਜੀ ਪਰਿਵਾਰ ਆਪਣਾ ਠੀਕ ਹੈ ਜੀ ਹੂੰ ਹੂੰ ਹਾਂਜੀ ਵਧੀਆ ਮੈਂ ਜੀ ਫ਼ੂਡ ਵਲੋਗਰ ਬੋਲਦੀ ਸੀ ਹਾਂਜੀ ਮੈਂ ਨਾ ਆਪਣੇ ਮੁਕਤਸਰ 'ਚ ਆਈ ਹੋਈ ਹਾਂ ਜੀ ਹਾਂਜੀ ਇੱਥੋਂ ਆਪਣੇ ਮੁਕਤਸਰ ਦਾ ਬੈਸਟ ਫ਼ੂਡ ਕਿੱਥੇ ਦਾ ਹੈਗਾ ਹੈ ਜੀ ਉਹ ਪੁੱਛਣਾ ਸੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਸਭ ਤੋਂ ਬੈਸਟ ਫ਼ੂਡ ਕਿਹਦਾ ਹੈਗਾ ਜੀ ਇੱਥੇ ਸਭ ਤੋਂ ਬੈਸਟ ਫ਼ੂਡ ਹਾਂਜੀ ਹਾਂਜੀ ਅੱਛਾ ਜੀ ਮਤਲਬ ਬਈ ਵਧੀਆ ਹੁੰਦਾ ਵਾ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਪੱਪੂ ਸਮੋਸਿਆਂ ਵਾਲੇ ਕੋਲ ਬੈਸਟ ਚੀਜ਼ ਕਿਹੜੀ ਮਤਲਬ ਮਿਲਦੀ ਹੈ ਪੱਪੂ ਸਮੋਸਿਆਂ ਵਾਲੇ ਕੋਲ ਬੈਸਟ ਫ਼ੂਡ ਕਿਹੜਾ ਮਿਲਦਾ ਹੈਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਬਰਗਰ ਵਗੈਰਾ ਹਾਂਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਬਸ ਮਤਲਬ ਇਹੀ ਪੁੱਛਣਾ ਸੀ ਮੈਂ ਫ਼ੂਡ ਵਲੋਗਰ ਸੀ ਤਾਂ ਕਰਕੇ ਮਤਲਬ ਜ਼ਿਆਦਾ ਜਾਣਕਾਰੀ ਚਾਹੀਦੀ ਸੀ ਇੱਥੇ ਆਈ ਹੋਈ ਸੀ ਮੈਂ ਮੈਨੂੰ ਜੀ ਪੱਪੂ ਬੈਸਟ ਲੱਗਿਆ ਪੱਪੂ ਸਮੋਸਿਆਂ ਵਾਲਾ ਹਾਂਜੀ ਇੱਥੇ ਜਾ ਕੇ ਮਤਲਬ ਟ੍ਰਾਇ ਕਰਾਂਗੇ ਵੀ ਕਿੱਦਾਂ ਦਾ ਹੈਗਾ ਫ਼ੂਡ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ